ਮੈਨੂੰ ਬਾਈਕ ਚਲਾਉਣ ਦਾ ਬਹੁਤ ਸ਼ੌਂਕ ਹੈ ਮੇਰੇ ਕੋਲ ਬੁਲਟ ਅਤੇ ਬਜਾਜ ਬਾਈਕਾਂ ਹਨ ਜਦ ਮੈਂ ਆਪਣੀ ਨਵੀਂ ਬੁਲਟ ਲਈ ਸੀ ਉਸ ਦੌਰਾਨ ਰੋਇਲ ਇਨਫਿਲਡ ਕੰਪਨੀ ਵੱਲੋਂ ਟੂਰਨਾਮੈਂਟ ਕਰਵਾਏ ਗਏ ਸਨ ਜਿਨ ਜਿਨ੍ਹਾਂ ਵਿੱਚ ਮੈਂ ਵੀ ਭਾਗ ਲਿਆ ਉਹ ਟੂਰ ਗਜਰਸੋਡ ਦਾ ਰੱਖਿਆ ਗਿਆ ਅਤੇ ਉਹ ਮੈਂ ਅਤੇ ਮੇਰਾ ਦੋਸਤ ਅਤੇ ਹੋਰ ਕਾਫ਼ੀ ਸੱਜਣ ਮਿੱਤਰ ਸਨ ਜੋ ਕਿ ਅਸੀਂ ਜਲੰਧਰ ਤੋਂ ਚੱਲੇ ਤਾਂ ਪੰਦਰ੍ਹਾਂ ਵੀਹ ਕਿਲੋਮੀਟਰ ਤੋਂ ਬਾਅਦ ਉਹਨਾਂ ਨੇ ਇੱਕ ਰਸਤੇ ਵਿੱਚ ਬਰੇਕ ਰੱਖੀ ਜਿਸ ਵਿੱਚ ਉਹਨਾਂ ਨੇ ਚਾਹ ਅਤੇ ਪਾਣੀ ਦਾ ਪ੍ਰੋਗਰਾਮ ਰੱਖਿਆ ਅਤੇ ਜਦ ਅਸੀਂ ਚਾਹ ਪਾਣੀ ਪੀਣ ਲਈ ਰੁਕੇ ਤਾਂ ਉੱਥੇ ਉਹਨਾਂ ਨੇ ਸਾਨੂੰ ਪੰਦਰ੍ਹਾਂ ਵੀਹ ਮਿੰਟ ਦਾ ਇਕ ਬਰੇਕ ਵੀ ਦਿੱਤਾ ਤਾਂ ਉਸ ਤੋਂ ਬਾਅਦ ਮੈਂ ਆਪਣੇ ਦੋਸਤ ਨਾਲ ਸ਼ੇਅਰਿੰਗ ਕਰਕੇ ਬੁਲਟ ਚਲਾਈ ਅਤੇ ਉਸ ਨੇ ਵੀ ਰਸਤੇ ਵਿੱਚ ਬੁਲਟ ਚਲਾਈ ਜਦੋਂ ਆਪਾਂ ਥੋੜ੍ਹਾ ਜਿਹਾ ਅੱਗੇ ਪਹੁੰਚੇ ਤਾਂ ਰਸਤੇ ਵਿੱਚ ਮੇਰੀ ਬੁਲਟ ਪੈਂਚਰ ਹੋ ਗਈ ਜਿਸ ਵਿੱਚ ਦੋਸਤ ਦੇ ਨਾਲ ਕਾਫ਼ੀ ਸੱਜਣਾਂ ਨੇ ਮੇਰੀ ਹੈਲਪ ਕੀਤੀ ਅਤੇ ਅਸੀਂ ਉਹ ਪੈਂਚਰ ਵਾਲੀ ਦੁਕਾਨ 'ਤੇ ਪਹੁੰਚ ਕੇ ਪੈਂਚਰ ਵੀ ਲਗਵਾਇਆ ਅਤੇ ਅਸੀਂ ਉਸ ਤੋਂ ਬਾਅਦ ਸਿੱਧਾ ਅਸੀਂ ਗਜਰਸੋਡ ਵਿੱਚ ਪਹੁੰਚੇ ਕਾਫ਼ੀ ਵਧੀਆ ਅਤੇ ਅੱਛਾ ਐਕਸਪੀਰੀਸ ਰਿਹਾ ਜਿਨ੍ਹਾਂ ਵਿੱਚ ਅਸੀਂ ਕਾਫ਼ੀ ਘੁੰਮਦੇ ਫਿਰਦੇ ਹੋਏ ਹੱਸਦੇ ਖੇਡਦੇ ਅਸੀਂ ਦੋਸਤਾਂ ਨਾਲ ਮਿਲਦੇ ਬੁਲਟ ਆਪਸ ਵਿੱਚ ਸ਼ੇਅਰਿੰਗ ਕਰਦੇ ਹੋਏ ਗਜਰਸੋਡ ਟਾਈਮ ਨਾਲ ਪਹੁੰਚ ਗਏ ਸੀ